ਅੱਠ ਪੱਚੀ ਹਜ਼ਾਰ ਅੱਠ ਸੌ ਤਰਵੰਜਾ ਇੱਕ ਲੱਖ ਨੜਿੱਨਵੇ ਹਜ਼ਾਰ ਨੌ ਸੌ ਇਕਾਨਵੇਂ ਪੰਜ ਲੱਖ ਪਚਵੰਜਾ ਹਜ਼ਾਰ ਨੌ ਲੱਖ ਨੌ ਹਜ਼ਾਰ ਪੰਜ ਸੌ ਇੱਕ